ਸਾਡੇ ਰਸੋਈ ਵਿੱਚ ਅਨੇਕਾਂ ਨਵੇਂ ਉਪਕਰਨ ਹਨ ਜਿਵੇਂ ਗਰੈਂਡਿੰਗ ਮਸ਼ੀਨ ਮਿਕਸੀ ਅਤੇ ਜੂਸਰ ਜਿਹਦੇ ਕਾਰਨ ਸਾਨੂੰ ਬਹੁਤ ਆਸਾਨੀ ਹੋਈ ਹੈ ਅਤੇ ਸਾਡੇ ਮਸ਼ੀਨ ਵਿੱਚ ਐੱਲ ਪੀ ਜੀ ਗੈਸ ਫਰਿੱਜ ਜਿਹਦੇ ਕਾਰਨ ਸਾਡੀ ਲਾਈਫ ਬਹੁਤ ਸੌਖੀ ਹੋ ਚੁੱਕੀ ਹੈ ਪਹਿਲਾਂ ਐਦਾਂ ਦੀ ਕੋਈ ਚੀਜ਼ ਨਹੀਂ ਹੁੰਦੀ ਸੀ ਜਿਹਦੇ ਕਰਕੇ ਸਾਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਅਸੀਂ ਸਾਰੇ ਹੀ ਕੰਮ ਬਹੁਤ ਹੀ ਆਸਾਨੀ ਨਾਲ਼ ਕਰ ਚੁੱਕੇ ਹਨ ਅਤੇ ਕਈ ਤਾਂ ਚੁੱਲ੍ਹੇ ਵੀ ਹਨ ਜੋ ਬਿਜਲੀ ਨਾਲ਼ ਚੱਲਦੇ ਹਨ ਜੋ ਕਿ ਪੈਸੇ ਦੀ ਬੱਚਤ ਕਰਨ ਵਿੱਚ ਸਾਡੀ ਮਦਦ ਕਰਦੇ ਹਨ ਅਤੇ ਪਹਿਲਾਂ ਅਸੀਂ ਹੱਥ ਨਾਲ਼ ਸਬਜ਼ੀਆਂ ਨੂੰ ਘੋਟੇ ਕਰਦੇ ਸੀ ਪਰ ਹੁਣ ਅਸੀਂ ਸਿੱਧਾ ਹੀ ਮਿਕਸੀ ਵਿੱਚ ਪਾ ਕੇ ਦੋ ਮਿੰਟ ਵਿੱਚ ਸਬਜ਼ੀ ਨੂੰ ਤਿਆਰ ਕਰ ਲੈਂਦੇ ਹਨ ਅਤੇ ਸਬਜ਼ੀ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਪਹਿਲਾਂ ਨਾਲੋਂ